ਭੰਗੜਾ ਐਰੋਬਿਕਸ ਦੇ ਬੜੇ ਫ਼ਾਇਦੇ ਹਨ ਰਵਾਇਤੀ ਪੰਜਾਬੀ ਸੰਗੀਤ ਅਤੇ ਡਾਂਸ ਦੀ ਵਰਤੋਂ ਨਾਲ ਅਸੀਂ ਆਪਣੀ ਕਸਰਤ ਕਰਨ ਦੇ ਤਰੀਕੇ ਨੂੰ ਬਦਲ ਸਕਦੇ ਹਾਂ ਅਤੇ ਇਸ ਨੂੰ ਬੜਾ ਮਜ਼ੇਦਾਰ ਅਤੇ ਬੜਾ ਹੀ ਜੋਸ਼ੀਲਾ ਬਣਾ ਸਕਦੇ ਹਾਂ ਕਿਉਂਕਿ ਜਦੋਂ ਅਸੀਂ ਭੰਗੜਾ ਪਾਉਂਦੇ ਹਾਂ ਤਾਂ ਸਾਡਾ ਸਾਰੇ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਨਾਲ ਦੀ ਨਾਲ ਸਾਡਾ ਆਪਣਾ ਜਿਹੜਾ ਮਨ ਦਾ ਸ਼ੌਂਕ ਹੈ ਉਹ ਵੀ ਪੂਰਾ ਹੁੰਦਾ ਹੈ ਭੰਗੜਾ ਮਨੋਰੰਜਨ ਦਾ ਇੱਕ ਸਾਧਨ ਵੀ ਹੈ ਅਤੇ ਕਸਰਤ ਦਾ ਇੱਕ ਤਰੀਕਾ ਵੀ ਹੈ ਭੰਗੜਾ ਐਰੋਬਿਕਸ ਜਿਹੜੀ ਨਵੀਂ ਟਰਮ ਅੱਜ ਕੱਲ੍ਹ ਕਸਰਤ ਦੇ ਵਿੱਚ ਆਈ ਹੈ ਇਸ ਨਾਲ ਕਸਰਤ ਨੂੰ ਇੱਕ ਨਵਾਂ ਨਵਾਂ ਜੀਵਨ ਮਿਲਿਆ ਹੈ ਕਿਉਂਕਿ ਅੱਜ ਕੱਲ੍ਹ ਦੀ ਜ਼ਿੰਦਗੀ ਵਿੱਚ ਲੋਕ ਕਸਰਤ ਤੋਂ ਮਨ ਚੁਰਾਉਂਦੇ ਹਨ ਕਸਰਤ ਕਰਨ ਤੋਂ ਦੂਰ ਭੱਜ ਰਹੇ ਹਨ ਕਿਉਂਕਿ ਉਹਨਾਂ ਕੋਲ ਬਹਾਨਾ ਕਿ ਸਾਨੂੰ ਸਮਾਂ ਨਹੀਂ ਮਿਲਦਾ ਜਦੋਂ ਇਸ ਨਾਲ ਸੰਗੀਤ ਜੁੜ ਜਾਂਦਾ ਹੈ ਤਾਂ ਹਰ ਇੱਕ ਦਾ ਮਨ ਇਸ ਕਸਰਤ ਨੂੰ ਕਰਨ ਨੂੰ ਕਰਦਾ ਹੈ ਅਤੇ ਨਾਲ ਹੀ ਉਹਨਾਂ ਦੇ ਸੰਗੀਤ ਦੀ ਭੁੱਖ ਵੀ ਪੂਰੀ ਹੁੰਦੀ ਹੈ ਇਸ ਤਰ੍ਹਾਂ ਭੰਗੜਾ ਐਰੋਬਿਕਸ ਸੰਗੀਤ ਅਤੇ ਡਾਂਸ ਦੀ ਵਰਤੋਂ ਦੇ ਨਾਲ ਨਾਲ ਕਸਰਤ ਕਰਨ ਨੂੰ ਬਹੁਤ ਮਜ਼ੇਦਾਰ ਬਣਾ ਰਿਹਾ ਹੈ ਅਤੇ ਸਾਰਿਆਂ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣਾ ਲੰਬੀ ਜ਼ਿੰਦਗੀ ਜਿਉ ਸਕੀਏ ਅਤੇ ਸਮਾਜ ਲਈ ਕੁਛ ਚੰਗਾ ਕਰ ਸਕੀਏ